ਮੌਸਮ ਸਾਰੇ ਹੀ ਪਸੰਦ ਹੈ ਜੀ ਕੋਈ ਖ਼ਾਸ ਐਸਾ ਨਹੀਂ ਹੈ ਕਿ ਆਹ ਵਾਲਾ ਪਸੰਦ ਹੈ ਆਹ ਨਹੀਂ ਪਸੰਦ ਹੈਗਾ ਪਰ ਜੇ ਗੱਲ ਕਰੀਏ ਤਾਂ ਜ਼ਿਆਦਾ ਚੰਗਾ ਮੌਸਮ ਘੁੰਮਣ ਫਿਰਨ ਵਾਸਤੇ ਬਸੰਤ ਤੋਂ ਲੈ ਕੇ ਗਰਮੀਆਂ ਦੀ ਸ਼ੁਰੂਆਤ ਦੇ ਵਿੱਚ ਦੇ ਜਿਹੜੇ ਸਾਨੂੰ ਪੰਜਾਹ ਸੱਠ ਦਿਨ ਮਿਲਦੇ ਆ ਉਹ ਸਭ ਤੋਂ ਜ਼ਿਆਦਾ ਵਧੀਆ ਹੁੰਦੇ ਆ ਹਮੇਸ਼ਾ ਅਤੇ ਜੇ ਤੁਸੀਂ ਬਰਫ ਦਾ ਇੰਜੋਏ ਕਰਨਾ ਵੀ ਮੈਂ ਬਰਫ਼ ਪਈ ਹੋਵੇ ਤਾਜ਼ੀ ਤਾਜ਼ੀ ਅਤੇ ਉਹਦਾ ਇੰਜੁਆਏਮੈਂਟ ਲੈਣੀ ਆ ਤਾਂ ਫਿਰ ਤੁਸੀਂ ਦਸੰਬਰ ਮਹੀਨੇ ਨੂੰ ਜਨਵਰੀ ਮਹੀਨੇ 'ਚ ਜਾਉ ਪਹਾੜਾਂ 'ਚ ਅਤੇ ਮੈਂ ਪਸੰਦ ਕਰਦਾ ਹਮੇਸ਼ਾ ਹੀ ਇਸ ਟਾਇਮ ਜਾਣਾ ਉੱਥੇ ਨੂੰ ਪਰ ਜੇ ਤੁਸੀਂ ਕਹੋ ਵੀ ਪੀਸਫੁੱਲ ਏਰੀਆ ਵੀ ਤੁਹਾਨੂੰ ਧੁੱਪ ਚੰਗੀ ਮਿਲੇ ਮੌਸਮ ਖਿੜਿਆ ਖਿੜਿਆ ਮਿਲੇ ਤਾਂ ਫਰਵਰੀ ਜਿਹੜਾ ਸਭ ਤੋਂ ਵਧੀਆ ਟਾਈਮ ਹੈਗਾ ਤੁਸੀਂ ਕਦੀ ਵੀ ਕਿਤੇ ਵੀ ਘੁੰਮਣ ਵਾਸਤੇ ਨਿਕਲੋ ਬਸੰਤ ਦਾ ਟਾਇਮ ਹੁੰਦਾ ਉਹ ਬਹੁਤ ਸੋਹਣਾ ਮੌਸਮ ਹੁੰਦਾ ਖੁਸ਼ਨੁਮਾ ਹੁੰਦਾ ਭੀੜ ਨਹੀਂ ਮਿਲੇਗੀ ਤੁਹਾਨੂੰ ਪਹਾੜਾਂ ਦੇ ਵਿੱਚ ਵੀ ਚੰਗਾ ਖੁੱਲ੍ਹਾ ਡੁੱਲਾ ਮਾਹੌਲ ਰਹੇਗਾ ਸਾਰਾ ਅਤੇ ਤੁਸੀਂ ਵਧੀਆ ਤਰੀਕੇ ਦੇ ਨਾਲ ਘੁੰਮ ਸਕਦੇ ਹੋ